ਮੈਨੂੰ ਡਾਂਸ ਦਾ ਬਹੁਤ ਸ਼ੌਕ ਹੈ ਅਤੇ ਮੈਂ ਆਪਣੇ ਇਸ ਸ਼ੌਕ ਲਈ ਹਮੇਸ਼ਾ ਉਤਸ਼ਾਹਿਤ ਰਹਿੰਦੀ ਹਾਂ ਡਾਂਸ ਦੇ ਹੁਨਰ ਲਈ ਤਕਨੀਕ ਕੋਰੀਓਗ੍ਰਾਫੀ ਅਤੇ ਗੁਣਵੱਤਾ ਪੂਰਵਕ ਪ੍ਰਦਰਸ਼ਨ ਦੀ ਜ਼ਰੂਰਤ ਹੁੰਦੀ ਹੈ ਪਰੰਤੂ ਇਹਨਾਂ ਤੋਂ ਇਲਾਵਾ ਕੁਝ ਹੋਰ ਤੱਤ ਵੀ ਹਨ ਜੋ ਮੇਰੇ ਇਸ ਹੁਨਰ ਨੂੰ ਸੁਧਾਰਨ ਵਿੱਚ ਮੈਨੂੰ ਅਕਸਰ ਪ੍ਰੇਰਿਤ ਕਰਦੇ ਹਨ ਜਿਵੇਂ ਦਰਸ਼ਕਾਂ ਨਾਲ ਅੱਖਾਂ ਨਾਲ ਅੱਖਾਂ ਮਿਲਾ ਕੇ ਪ੍ਰਦਰਸ਼ਨ ਕਰਨਾ ਆਤਮ ਵਿਸ਼ਵਾਸ ਹੋਣਾ ਚੰਗੀ ਤਰ੍ਹਾਂ ਪ੍ਰੈਕਟਿਸ ਕਰਦੇ ਰਹਿਣਾ ਅਤੇ ਨਾਲ ਹੀ ਡਾਂਸ ਕੌਂਪੀਟੀਸ਼ਨ ਵਿੱਚ ਪਾਰਟੀਸੀਪੇਟ ਕਰਨਾ ਇਸ ਨਾਲ ਸਾਨੂੰ ਕੁਝ ਹੋਰ ਨਵਾਂ ਸਿੱਖਣ ਨੂੰ ਮਿਲਦਾ ਹੈ ਅਤੇ ਗਲਤੀਆਂ ਸੁਧਾਰਨ ਦਾ ਵੀ ਇੱਕ ਮੌਕਾ ਮਿਲ ਜਾਂਦਾ ਹੈ ਅਸੀਂ ਆਪਣੇ ਆਪ ਨੂੰ ਪ੍ਰੋਫੈਸ਼ਨਲੀ ਪੇਸ਼ ਕਰ ਸਕਦੇ ਹਾਂ ਅੱਜ ਕੱਲ੍ਹ ਇੰਟਰਨੈੱਟ ਅਤੇ ਯੂਟਿਊਬ ਦੀ ਸਹਾਇਤਾ ਨਾਲ ਨਵੇਂ ਤੋਂ ਨਵੇਂ ਤਰ੍ਹਾਂ ਦੇ ਸਟੈਪ ਸਿੱਖਣ ਨੂੰ ਮਿਲ ਜਾਂਦੇ ਹਨ ਜੋ ਕਿ ਬਹੁਤ ਸੌਖੇ ਢੰਗ ਨਾਲ ਸਿਖਾਏ ਜਾਂਦੇ ਹਨ ਇਸ ਨਾਲ ਮੈਂ ਘਰ ਬੈਠੇ ਆਪਣੇ ਇਸ ਹੁਨਰ ਨੂੰ ਹੋਰ ਵਧੀਆ ਕਰ ਸਕਦੀ ਹਾਂ ਜੋ ਕਿ ਮੇਰੇ ਲਈ ਬਹੁਤ ਹੀ ਵਧੀਆ ਤਰੀਕਾ ਹੈ ਧੰਨਵਾਦ